ਹਾਂਜੀ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਪਰ ਮੇਰੇ ਮਾਤਾ ਜੀ ਜੋ ਹੈ ਬਰੇਲੀ ਯੂ ਪੀ ਸਾਈਡ ਰਹਿੰਦੇ ਉਨ੍ਹਾਂ ਦਾ ਉੱਥੇ ਉਨ੍ਹਾਂ ਦਾ ਉੱਥੇ ਪੇਕੇ ਹੈ ਪਰ ਜਦੋਂ ਮੈਂ ਉਨ੍ਹਾਂ ਦੇ ਨਾਲ ਉੱਥੇ ਗਿਆ ਤਾਂ ਉਨ੍ਹਾਂ ਦੀ ਵੱਖਰੀ ਭਾਸ਼ਾ ਅਤੇ ਸੱਭਿਆਚਾਰ ਦੇਖਣ ਨੂੰ ਮਿਲਿਆ ਉੱਥੇ ਜਾ ਕੇ ਕਿਆ ਸਭ ਕੁਝ ਮਤਲਬ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕਿਆ ਕਰਾਂ ਉੱਥੇ ਦੀ ਲੈਗੁਏਜ਼ ਸਾਰੀ ਅਲੱਗ ਸੀ ਉਹ ਕਿਆ ਬੋਲ਼ਦੇ ਸੀ ਮੈਨੂੰ ਕੁਛ ਸਮਝ ਨਹੀਂ ਆਉਂਦਾ ਸੀ ਪਰ ਉਸ ਦਾ ਸੰਚਾਰ ਮੈਨੂੰ ਮੇਰੇ ਮਾਤਾ ਜੀ ਨੇ ਕਰਕੇ ਦਿੱਤਾ ਜਿਵੇਂ ਉਹ ਮੈਨੂੰ ਕੁਛ ਵੀ ਜੋ ਮੈਂ ਪੁੱਛਦਾ ਤਾ ਵੀ ਕਿਆ ਬੋਲ਼ੇ ਹੈ ਤਾਂ ਉਹ ਮੈਨੂੰ ਪੰਜਾਬੀ ਵਿੱਚ ਦੱਸ ਦਿੰਦੇ ਸੀ ਉਸ ਤੋਂ ਬਾਅਦ ਮੈਂ ਉਸਨੂੰ ਅਨੁਕੂਲ ਇਸ ਤਰੀਕੇ ਨਾਲ ਬਣਾਇਆ ਵੀ ਹਾਂ ਵੀ ਮੈਨੂੰ ਮਾਤਾ ਜੀ ਹਰ ਇੱਕ ਚੀਜ਼ ਦੱਸ ਦਿੰਦੇ ਸੀ ਅਤੇ ਰਹੀ ਗੱਲ ਉੱਧਰ ਦੀ ਗੱਲ ਕਰਾਂ ਤਾਂ ਜਿਵੇਂ ਪੰਜਾਬ ਵਿੱਚ ਲੋਕ ਜਿਵੇਂ ਰਹਿੰਦੇ ਹਨ ਓਰੇ ਬਿਜਲੀ ਵਗੈਰਾ ਸਾਰੀ ਟਾਇਮ 'ਤੇ ਆਉਂਦੀ ਹੈ ਬੰਦੇ ਆਰਾਮ ਨਾਲ ਘੁੰਮ ਫਿਰ ਸਕਦੇ ਹਨ ਪਰ ਉੱਥੇ ਜੋ ਹੈ ਬਿਜਲੀ ਦਾ ਕੱਟ ਬਹੁਤ ਲੱਗਦਾ ਉੱਥੇ ਜਿਵੇਂ ਦਿਨ ਵਿੱਚ ਤਿੰਨ ਚਾਰ ਘੰਟੇ ਹੀ ਬਿਜਲੀ ਆਉਂਦੀ ਹੈ ਜ਼ਿਆਦਾਤਰ ਉੱਥੇ ਦੇ ਸੱਤ ਵਜੇ ਛੇ ਸੱਤ ਵਜੇ ਤੋਂ ਬਾਅਦ ਉੱਥੇ ਬੰਦੇ ਬਾਹਰ ਨਹੀਂ ਨਿਕਲਦੇ ਅਤੇ ਜਿਵੇਂ ਪੰਜਾਬ ਵਿੱਚ ਆਪਾਂ ਦੇਖੀਏ ਤਾਂ ਨੌ ਦਸ ਗਿਆਰ੍ਹਾਂ ਬਾਰ੍ਹਾਂ ਵਜੇ ਤੱਕ ਵੀ ਬੰਦੇ ਬਾਹਰ ਘੁੰਮਦੇ ਰਹਿੰਦੇ ਹਨ